ਜਦੋਂ ਅਸੀਂ ਕੋਈ ਵੀ ਕੰਮ ਕਰਦੇ ਹਾਂ ਸਾਨੂੰ ਜਿਹੜਾ ਹੈਗਾ ਸਾਵਧਾਨੀ ਨਾਲ ਹੀ ਕਰਨਾ ਚਾਹੀਦਾ ਜਿਵੇਂ ਆਪਾਂ ਕਿਚਨ ਦੇ ਵਿੱਚ ਕੋਈ ਕੰਮ ਕਰ ਰਹੇ ਹਾਂ ਕੋਈ ਆਪਾਂ ਖਾਣਾ ਬਣਾ ਰਹੇ ਹੈਗੇ ਹਾਂ ਆਪਾਂ ਨੂੰ ਚਿਕਨ ਕਿਚਨ ਦੇ ਵਿੱਚ ਬਹੁਤ ਜਿਹੜਾ ਹੈਗਾ ਸਾਵਧਾਨੀ ਨਾਲ ਰਹਿਣਾ ਪੈ ਰਿਹਾ ਹੁੰਦਾ ਰਹਿਣਾ ਰਹਿਣਾ ਪੈਂਦਾ ਹੈਗਾ ਆਪਾਂ ਨੂੰ ਕੀ ਕੀ ਸਾਵਧਾਨੀ ਆਪਾਂ ਵਰਤਦੇ ਹਾਂ ਉੱਥੇ ਆਪਾਂ ਨੂੰ ਦੇਖਣਾ ਚਾਹੀਦਾ ਜਿਹੜਾ ਹੈਗਾ ਆਪਣੀ ਜਿਹੜੀ ਪਹਿਲਾ ਨੰਬਰ ਤਾਂ ਇਹ ਜਿਹੜੀ ਆਪਣੀ ਕਿਚਨ ਹੈਗੀ ਆ ਉਹ ਖੁੱਲ੍ਹੀ ਹੋਣੀ ਚਾਹੀਦੀ ਹੈਗੀ ਆ ਹਵਾਦਾਰ ਹੋਣੀ ਚਾਹੀਦੀ ਹੈਗੀ ਆ ਰੋਸ਼ਨੀਦਾਰ ਹੋਣੀ ਚਾਹੀਦੀ ਹੈਗੀ ਹੈਗੀ ਠੀਕ ਹੈ ਸਿਲਿੰਡਰ ਜਿਹੜਾ ਹੈਗਾ ਉਹਦੇ ਵਿੱਚ ਸਿਲਿੰਡਰ ਨੂੰ ਚੈੱਕ ਕਰਨਾ ਚਾਹੀਦਾ ਸਾਰਿਆਂ ਨਾਲੋਂ ਪਹਿਲਾਂ ਆਪਾਂ ਨੂੰ ਸਿਲਿੰਡਰ ਚਲਾਉਣ ਤੋਂ ਪਹਿਲਾਂ ਵੀ ਉਹਦੀ ਲੀਕੇਜ ਵਗੈਰਾ ਤਾਂ ਨਹੀਂ ਹੋ ਰਹੀ ਜੇ ਲੀਕੇਜ ਵਗੈਰਾ ਹੋ ਰਹੀ ਹੈਗੀ ਆ ਤਾਂ ਆਪਾਂ ਨੂੰ ਉਹਦੇ 'ਤੇ ਆਪਾਂ ਨੂੰ ਸਲਊਸ਼ਨ ਲੱਭਣਾ ਚਾਹੀਦਾ ਹੈਗਾ ਠੀਕ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਜਦੋਂ ਆਪਾਂ ਕੁਛ ਪਕਾਉਣ ਜਗ ਲੱਗਦੇ ਹੈਗੇ ਹਾਂ ਤਾਂ ਆਪਾਂ ਨੂੰ ਆਪਣਾ ਜਿਹੜਾ ਹੈਗਾ ਗਾ ਹੱਥ ਕਵਰ ਕਰਨੇ ਚਾਹੀਦੇ ਹੈਗੇ ਆ ਹੱਥਾਂ ਨੂੰ ਬਚਾਉਣਾ ਚਾਹੀਦਾ ਵੀ ਹੱਥਾਂ ਦੇ ਉੱਪਰ ਕੁਛ ਤੇਲ ਵਗੈਰਾ ਨਾ ਡਿੱਗ ਜਾਵੇ ਆਪਣੇ ਕੱਪੜਿਆਂ ਨੂੰ ਆਪਾਂ ਨੂੰ ਸਾਵਧਾਨੀ ਨਾਲ ਰੱਖਣਾ ਚਾਹੀਦਾ ਕੱਪ ਆਪਣੇ ਦੁਪੱਟਾ ਵਗੈਰਾ ਨੂੰ ਆਪਾਂ ਨੂੰ ਚੰਗੀ ਤਰ੍ਹਾਂ ਟਾਈਟ ਬੰਨ੍ਹਣਾ ਚਾਹੀਦਾ ਹੈਗਾ ਤਾਂ ਕਿ ਉਹ ਆਪਣੀ ਤੇ ਤੇ ਸਲਿੰਡਰ ਦੀ ਜਿਹੜੀ ਹੈਗੀ ਹੈਗੀ ਫਲੇਮ ਦੇ ਨਾਲ ਨਾ ਲੱਗ ਜਾਵੇ ਅਤੇ ਆਪਾਂ ਨੂੰ ਸਾਰਾ ਧਿਆਨ ਜਿਹੜਾ ਹੈਗਾ ਕੁਕਿੰਗ ਵਿੱਚ ਹੀ ਦੇਣਾ ਚਾਹੀਦਾ ਇੱਧਰ ਉੱਧਰ ਆਪਾਂ ਨੂੰ ਗੱਲਾਂ ਨਹੀਂ ਮਾਰਨੀਆਂ ਚਾਹੀਦੀਆਂ ਗੱਲਾਂ ਮਾਰਾਂਗੇ ਤਾਂ ਆਪਾਂ ਜਿਹੜਾ ਹੈਗਾ ਡਿਸਟਰਕਸ਼ਨ ਪੈਦਾ ਹੋਊਗੀ ਆਪਣੇ ਆਪਾਂ ਕੁਕਿੰਗ ਵੱਲ ਆਪਾਂ ਧਿਆਨ ਨਹੀਂ ਦੇ ਸਕਾਂਗੇ ਠੀਕ ਹੈ ਆਪਾਂ ਨੂੰ ਉਹਨੂੰ ਜਲਣ ਤੋਂ ਵੀ ਬਚਾਉਣਾ ਚਾਹੀਦਾ ਆਪਾਂ ਨੂੰ ਆਪਣੇ ਆਪ ਨੂੰ ਸੇਵ ਕਰਨਾ ਚਾਹੀਦਾ ਜੇ ਆਪਾਂ ਕੋਈ ਕੁਕਿੰਗ ਕਰ ਰਹੇ ਹੈਗੇ ਹਾਂ ਕੋਈ ਚੀਜ਼ ਆਪਣੀ ਬਣ ਗਈ ਹੈਗੀ ਹੈਗੀ ਆਪਾਂ ਉਹਨੂੰ ਜਿਵੇਂ ਕੂਕਰ ਹੈਗਾ ਆਪਣੇ ਸਬਜ਼ੀ ਬਣਾ ਰਹੇ ਹਾਂ ਕੁਕਰ ਦੇ ਵਿੱਚ ਜਦੋਂ ਆਪਣੀ ਸਬਜ਼ੀ ਬਣ ਗਈ ਆਪਾਂ ਕੁਕਰ ਨੂੰ ਉਤਾਰਨਾ ਹੈਗਾ ਤਾਂ ਆਪਾਂ ਨੂੰ ਉਹਨੂੰ ਗਰਮ ਨਹੀਂ ਗਰਮ ਨਹੀਂ ਲੱਥਣਾ ਚਾਹੀਦਾ ਆਪਾਂ ਨੂੰ ਉਹਦੀ ਸਟੀਲ ਜਿਹੜੀ ਇੱਕ ਪਲਾਸਟਿਕ ਦਾ ਹੈਂਡਲ ਹੁੰਦਾ ਸਿਰਫ ਉਸੇ ਨੂੰ ਫੜ ਕੇ ਨੀਚੇ ਉਤਾਰਨਾ ਚਾਹੀਦਾ ਹੈਗਾ ਜਿਹੜਾ ਆਪਣੇ ਕੋਲ ਜਿੱਥੇ ਸਟੀਲ ਹੈਗਾ ਲੱਗਿਆ ਹੋਇਆ ਪਲਾਸਟਿਕ ਨਹੀਂ ਲੱਗਿਆ ਹੋਇਆ ਆਪਾਂ ਨੂੰ ਉੱਥੇ ਹੱਥ ਨਹੀਂ ਲਾਉਣਾ ਚਾਹੀਦਾ ਜੇ ਆਪਾਂ ਉੱਥੇ ਹੱਥ ਲਾਵਾਂਗੇ ਤਾਂ ਆਪਣਾ ਹੱਥ ਜਿਹੜਾ ਉਹ ਜਲ ਸਕਦਾ ਹੈਗਾ